ਗੁਰਪੁਰਬ ਵਿਸਾਖੀ ਲੋਹੜੀ ਦਿਵਾਲੀ ਹੋਲੀ ਵਰਗੇ ਤਿਉਹਾਰ ਸਾਡੇ ਭਾਰਤ ਵਰਗੇ ਜ਼ਿਲਿਆਂ 'ਚ ਮਨਾਏ ਜਾਂਦੇ ਹਨ ਇਸ ਤੋਂ ਇਲਾਵਾ ਗਾਂਧੀ ਜੈਯੰਤੀ ਰਾਮ ਨੌਮੀ ਵਰਗੇ ਕੁਝ ਤਿਉਹਾਰ ਹਨ ਜਿਹੜੇ ਕਿ ਸਾਡੇ ਪੂਰੇ ਅ ਭਾਰਤ 'ਚ ਮਨਾਏ ਜਾਏ ਜਾਂਦੇ ਹਨ ਜਿਹਦੇ ਨਾਲ ਏ ਏ ਪਹਿਲੇ ਆਉਂਦੀ ਆ ਹੋਲੀ ਹੋਲੀ ਦੇ ਵਿੱਚ ਆਪਾਂ ਆਪਣੇ ਰੰਗ ਲਾ ਕੇ ਇੱਕ ਦੂਜੇ ਨੂੰ ਰੰਗ ਲਾ ਕੇ ਖੁਸ਼ੀ ਦਾ ਪ੍ਰਗਟਾਵਾ ਕਰਦੇ ਹਾਂ ਵਿਸਾਖੀ ਦੇ ਵਿੱਚ ਅਸੀਂ ਪਹਿਲੀ ਕਣਕ ਦੀ ਵਾਢੀ ਦੀ ਖੁਸ਼ੀ ਦੇ ਵਿੱਚ ਇਸ ਚੀਜ਼ ਨੂੰ ਮਨਾਉਦੇ ਹਾਂ ਅਤੇ ਨਾਲੇ ਸਾਡੇ ਗੁਰੂ ਦਸਵੇਂ ਪਾਤਸ਼ਾਹੀਆਂ ਨੇ ਅ ਇਸ ਚੀਜ਼ ਨੂੰ ਚੰਗੇ ਤਰੀਕੇ ਨਾਲ ਮਨਾਇਆ ਸੀ ਕਿਉਂਕਿ ਇਸੇ ਸਮੇਂ ਤੁਹਾਡੇ ਸਿੱਖ ਪੰਥ ਦੀ ਸਾਜਨਾ ਹੋਈ ਸੀ ਨਾਲ ਹੀ ਨਾਲ ਦਿਵਾਲੀ ਦਿਵਾਲੀ ਦੇ ਦਿਨ ਅਸੀਂ ਦੀਵੇ ਲਾ ਕੇ ਹਰ ਇੱਕ ਘਰ ਦੇ ਵਿੱਚ ਮਿਠਾਈਆਂ ਵੰਡ ਕੇ ਇੱਕ ਦੂਜੇ ਦੇ ਨਾਲ ਖੁਸ਼ੀ ਪ੍ਰਗਟਾਵਾ ਕਰਦੇ ਹਾਂ ਅਤੇ ਨਾਲ ਹੀ ਆਪਾਂ ਇਸ ਚੀਜ਼ ਨੂੰ ਹਰ ਇੱਕ ਤਰੀਕੇ ਨਾਲ ਪਟਾਕੇ ਛੱਡ ਕੇ ਇਸ ਚੀਜ਼ ਦੀ ਖੁਸ਼ੀ ਮਨਾਉਦੇ ਹਾਂ ਕਿ ਸਾਡੇ ਸਾਡੇ ਰਾਮ ਰਾਮ ਸ਼੍ਰੀ ਰਾਮ ਇਸ ਸਮੇਂ ਆਪਣੀ ਚੌਦਾਂ ਸਾਲ ਦੇ ਬਨਵਾਸ ਤੋਂ ਵਾਪਸ ਆਏ ਸੀ